ਇੱਕ ਸੌ ਚਾਰ ਬਾਰਾਂ ਸੌ ਅੱਠ ਉੱਨੀ ਹਜ਼ਾਰ ਅੱਠ ਸੌ ਪੈਂਤੀ ਇੱਕ ਹਜ਼ਾਰ ਇੱਕ ਸੌ ਨੜਿਨਵੇਂ ਤਿੰਨ ਲੱਖ ਚਾਲੀ ਹਜ਼ਾਰ